ਹਾਂਜੀ ਸਾਡੇ ਪਿੰਡਾਂ ਅਤੇ ਇਲਾਕੇ ਵਿੱਚ ਸਾਡੇ ਏਰੀਏ 'ਚ ਲੋਕੀ ਕਾਲੇ ਧਾਗੇ ਪੈਰਾਂ ਨੂੰ ਹੱਥਾਂ ਨੂੰ ਬੰਨਦੇ ਆ ਅਤੇ ਉਹ ਵਹਿਮਾਂ ਭਰਮਾਂ ਵਿੱਚ ਬਸ ਬਹੁਤ ਵਿਸ਼ਵਾਸ ਕਰਦੇ ਹਨ ਨਿੰਬੂ ਮਿਰਚੀ ਬੰਨ ਕੇ ਵੀ ਉਹ ਵਹਿਮਾਂ ਭਰਮਾਂ ਵਿੱਚ ਰਹਿੰਦੇ ਹਨ